ਪੰਜ ਨਵੰਬਰ ਅਠਾਰ੍ਹਾਂ ਸੌ ਅੱਸੀ ਬਾਰ੍ਹਾਂ ਅਕਟੂਬਰ ਪੰਦਰ੍ਹਾਂ ਸੌ ਸੱਠ ਤੇਰ੍ਹਾਂ ਜਨਵਰੀ ਉੱਨੀ ਸੌ ਨੱਬੇ ਅਠਾਰ੍ਹਾਂ ਫਰਵਰੀ ਦੋ ਹਜ਼ਾਰ ਉੱਨੀ ਨੌ ਅਪ੍ਰੈਲ ਉੱਨੀ ਸੌ ਨੜਿਨਵੇਂ